ਭੰਗੜਾ ਐਰੋਬਿਕਸ ਅਸਲ ਵਿੱਚ ਸਰੀਰਕ ਗਤੀਵਿਧੀ ਦਾ ਇੱਕ ਜੀਵਤ ਅਤੇ ਪ੍ਰਭਾਵੀ ਰੂਪ ਹੈ ਜੋ ਰਵਾਇਤੀ ਪੰਜਾਬੀ ਡਾਂਸ ਨੂੰ ਐਰੋਬਿਕ ਅਭਿਆਸਾਂ ਨਾਲ ਜੋੜਦਾ ਹੈ ਜਿਸ ਨਾਲ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਤੰਦਰੁਸਤੀ ਦੋਵਾਂ ਲਈ ਬਹੁਤ ਸਾਰੇ ਲਾਭ ਹੁੰਦੇ ਹਨ ਇਹ ਊਰਜਾਵਾਨ ਕਸਰਤ ਗਤੀਸ਼ੀਲ ਅੰਦੋਲਨ ਤਾਲਬੰਦ ਕਦਮਾਂ ਅਤੇ ਸੱਭਿਆਚਾਰਕ ਸੰਗੀਤ ਨੂੰ ਜੋੜਦੀ ਹੈ ਜੋ ਇਕੱਠੇ ਇੱਕ ਮਜ਼ੇਦਾਰ ਅਤੇ ਦਿਲਚਸਪ ਕਸਰਤ ਅਨੁਭਵ ਬਣਾਉਂਦੇ ਹਨ ਇੱਕ ਐਰੋਬਿਕ ਕਸਰਤ ਦੇ ਰੂਪ ਵਿੱਚ ਭੰਗੜਾ ਐਰੋਬਿਕਸ ਦਿਲ ਦੀ ਧੜਕਣ ਨੂੰ ਵਧਾ ਕੇ ਅਤੇ ਸਮੁੱਚੀ ਧੀਰਜ ਨੂੰ ਵਧਾ ਕੇ ਕਾਰਡੀਓਵੈਸਕੂਲਰ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਮਾਸਪੇਸ਼ੀ ਟੋਨਿੰਗ ਅਤੇ ਤਾਕਤ ਬਣਾਉਣ ਵਿੱਚ ਵੀ ਯੋਗਦਾਨ ਪਾਉਂਦਾ ਹੈ ਖਾਸ ਤੌਰ 'ਤੇ ਹੇਠਲੇ ਸਰੀਰ ਵਿੱਚ ਕੋਰ ਵਿੱਚ ਵੱਖੋ ਵੱਖਰੇ ਡਾਂਸ ਸਟੈਪਸ ਅਤੇ ਉੱਚ ਊਰਜਾ ਵਾਲੇ ਰੂਟੀਨ ਦੇ ਕਾਰਨ ਇਸ ਤੋਂ ਇਲਾਵਾ ਭੰਗੜਾ ਰੂਟੀਨ ਦੀ ਤਾਲਬੱਧ ਅਤੇ ਉਹਦਾ ਦੁਹਰਾਉਣ ਵਾਲੀ ਪ੍ਰਤੀਕ੍ਰਿਆ ਤਾਲਮੇਲ ਸੰਤੁਲਨ ਅਤੇ ਲਚਕਤਾ ਨੂੰ ਬਿਹਤਰ ਬਣਾਉਣ ਵਿੱਚ ਸਿਹਤ ਕਰ ਸਕਦੀ ਹੈ ਉਹ ਉਤਕਲਾਬਾਂ ਤੋਂ ਇਲਾਵਾ ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣਾ ਮੂੜ ਨੂੰ ਵਧਾ ਸਕਦਾ ਹੈ ਅਤੇ ਤਨਾਅ ਨੂੰ ਘਟਾ ਸਕਦਾ ਹੈ ਕਿਉਂਕਿ ਡਾਂਸ ਪਹਿਲੂ ਰਚਨਾਤਮਕ ਪ੍ਰਗਟਾਵੇ ਅਤੇ ਸਮਾਜਿਕ ਪਰਸਪਰ ਪ੍ਰਭਾਵ ਦੀ ਆਗਿਆ ਦਿੰਦਾ ਹੈ ਪਰੰਪਰਾਗਤ ਪੰਜਾਬੀ ਸੰਗੀਤ ਨ੍ਰਿੱਤ ਦੇ ਤੱਤਾਂ ਨੂੰ ਸ਼ਾਮਿਲ ਕਰਨ ਨਾਲ ਭਾਗ ਲੈਣ ਵਾਲਿਆਂ ਵਿੱਚ ਸੱਭਿਆਚਾਰਕ ਸੰਬੰਧ ਅਤੇ ਭਾਈਚਾਰੇ ਦੀ ਭਾਵਨਾ ਵੀ ਪੈਦਾ ਹੋ ਸਕਦੀ ਹੈ ਕੁੱਲ ਮਿਲਾ ਕੇ ਭੰਗੜਾ ਐਰੋਬਿਕਸ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਪੇਸ਼ ਕਰਦਾ ਹੈ ਜੋ ਸਰੀਰਕ ਕਸਰਤ ਨੂੰ ਸੱਭਿਆਚਾਰਕ ਸੰਸ਼ੋਧਨ ਦੇ ਨਾਲ ਜੋੜਦਾ ਹੈ ਇਸ ਨੂੰ ਵਿਭਿੰਨ ਆਬਾਦੀ ਲਈ ਇੱਕ ਕੀਮਤੀ ਅਤੇ ਆਨੰਦ ਦਾਇਕ ਗਤੀਵਿਧੀ ਬਣਾਉਂਦਾ ਹੈ